ਹਾਂ ਮੇਰੇ ਸਕੂਲ ਕਾਲਜ ਵਿੱਚ ਇੱਕ ਅਧਿਆਪਕ ਸੀ ਜਿਹੜੇ ਕਿ ਬਹੁਤ ਵਧੀਆ ਚਿੱਤਰ ਬਣਾਉਂਦੇ ਸੀ ਅਤੇ ਉਹ ਸਾਨੂੰ ਸਿਖਾਉਂਦੇ ਸੀ ਕਿਸ ਤਰ੍ਹਾਂ ਚਿੱਤਰ ਬਣਾਉਣੇ ਹਨ ਅਤੇ ਸਕੂਲ ਕਾਲਜ ਵਿੱਚ ਅਧਿਆਪਕ ਸਾਨੂੰ ਹਰ ਤਰ੍ਹਾਂ ਦੇ ਚਿੱਤਰ ਬਣਾਉਣੇ ਅਤੇ ਸਿਖ ਸਿਖਾਉਂਦੇ ਸੀ ਅਤੇ ਰੰਗ ਤਾਂ ਸਭ ਦੇ ਰੰਗਾਂ ਬਾਰੇ ਸਾਨੂੰ ਦੱਸਦੇ ਸੀ ਅਤੇ ਉਹ ਕਹਿੰਦੇ ਸੀ ਕਿ ਮਤਲਬ ਅ ਤੁਸੀਂ ਵੀ ਬਹੁਤ ਵਧੀਆ ਚਿੱਤਰ ਬਣਾ ਸਕਦੇ ਹੋ ਅਤੇ ਤਰ੍ਹਾਂ ਤਰ੍ਹਾਂ ਦੇ ਚਿੱਤਰ ਬਣਾਉਣੇ ਬਣਾਉਣੇ ਸੀ ਅਤੇ ਮੇਰਾ ਵੀ ਹੈ ਸੁਪਨਾ ਕਿ ਮੈਂ ਵੀ ਬਹੁਤ ਵਧੀਆ ਚਿੱਤਰਕਾਰ ਬਣਾ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਮੈਨੂੰ ਵੀ ਰੰਗ ਲਿਆ ਕੇ ਦਿਓ ਅਤੇ ਮੈਂ ਵੀ ਚਿੱਤਰ ਬਣਾਉਣੇ ਹਨ ਅਤੇ ਮੈਂ ਘਰ ਬੈਠ ਕੇ ਚਿੱਤਰ ਬਣਾਉਣ ਬਣਾਉਂਦੀ ਹਾਂ